ਹੈਲੋ ਹਾਂਜੀ ਮੈਮ ਮੈਂ ਵਧੀਆ ਮੈਮ ਤੁਸੀਂ ਦੱਸੋ ਹਾਂਜੀ ਮੈਮ ਅੱਛਾ ਜੀ ਮੈਂ ਤਾਂ ਮੈਮ ਜਿਆਦਾਤਰ ਅੰਮ੍ਰਿਤਾ ਪ੍ਰੀਤਮ ਦੀ ਬੁੁੱਕ ਈ ਪੜਦਾ ਜਿਵੇਂ ਕਿ ਰਸੀਦੀ ਟਿਕਟ ਵਗੈਰਾ ਤੇ ਉਹਨਾਂ ਦੀ ਲਿਖੀ ਹਾਂਜੀ ਹਾਂਜੀ ਮੈਮ ਉਹਨਾਂ ਦੇ ਨਾਵਲ ਬਹੁਤ ਵਧੀਆ ਹੁੰਦੇ ਹਨ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਮੈਮ ਹਾਂਜੀ ਹੋਰ ਰਾਈਟਰਾਂ ਦੀ ਵੀ ਕਿਤਾਬਾਂ ਵਧੀਆ ਹੁੰਦੀਆਂ

ਹਾਂਜੀ ਮੈਮ ਹਾਂਜੀ ਜਿਆਦਾਤਰ ਤਾਂ ਪੰਜਾਬੀ ਸੱਭਿਆਬਾ ਚਾਰ ਬਾਰੇ ਦੱਸਿਆ ਹੋਇਆ ਤੇ ਹਾਜੀ ਠੀਕ ਐ ਜੀ ਹਾਂਜੀ ਮੈਂ ਹੋਰ ਰਾਈਟਰਾਂ ਦੀ ਬੁਕ ਵੀ ਪੜ੍ਦਾ ਪਰ ਮੈਨੂੰ ਪਰ ਜਿਆਦਾਤਰ ਤਾਂ ਮੈਂ ਇਹਨਾਂ ਦੀ ਪੜਦਾ ਅੰਮ੍ਰਿਤਾ ਪ੍ਰੀਤਮ ਦੀ ਹਾਂਜੀ ਮੈਮ ਓਕੇ ਮੈਮ